ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਕੈਟਲ ਫੀਡ ਤੋਂ ਬੋਲ ਰਹੇ ਹੋ ਹਾਂਜੀ ਸਰ ਸਰ ਅਸੀਂ ਮਤਲਬ ਰਾਜੂ ਨੇ ਤੁਹਾਡਾ ਨੰਬਰ ਦਿੱਤਾ ਸੀ ਅਸੀਂ ਨਾ ਹੁਣੇ ਹੁਣੇ ਇੱਥੇ ਤੁਹਾਡੇ ਸ਼ਹਿਰ ਦੇ ਵਿੱਚ ਨਵੇਂ ਸ਼ਿਫਟ ਹੋਏ ਹਾਂ ਹਾਂਜੀ ਅਤੇ ਸਰ ਮਤਲਬ ਨਾ ਸਾਡੇ ਘਰ ਪਸ਼ੂ ਵਗੈਰਾ ਰੱਖੇ ਹੋਏ ਨੇ ਅਤੇ ਅਸੀਂ ਹੋਰ ਵੀ ਔਰਗੈਨਿਕ ਵੀ ਮਤਲਬ ਸਬਜ਼ੀਆਂ ਵਗੈਰਾ ਵੀ ਬੀਜ਼ਦੇ ਹਾਂ ਅਤੇ ਤੁਹਾਡੀ ਬੀਜ਼ਾਂ ਦੀ ਸ਼ੋਪ ਵਗੈਰਾ ਹਾਂਜੀ ਸਰ ਸਾਨੂੰ ਨਾ ਮਤਲਬ ਵੀ ਪਸ਼ੂਆਂ ਲਈ ਅਤੇ ਉਹਨਾਂ ਲਈ ਪਸ਼ੂਆਂ ਲਈ ਤਾਂ ਫੀਡ ਵਗੈਰਾ ਚਾਹੀਦੀ ਹੈ ਅਤੇ ਮਤਲਬ ਅਸੀਂ ਜਿਹੜੀਆਂ ਰੇਹਾਂ ਸਪਰੇਹਾਂ ਸਾਨੂੰ ਉਹ ਵੀ ਚਾਹੀਦੀਆਂ ਨੇ ਸਾਨੂੰ ਜਿਨ੍ਹਾਂ ਨੇ ਤੁਹਾਡਾ ਨ ਕੰਟੈਕਟ ਨੰਬਰ ਦਿੱਤਾ ਸੀ ਉਹਨਾਂ ਨੇ ਦੱਸਿਆ ਸੀ ਕਿ ਤੁਹਾਡੀ ਸ਼ੋਪ 'ਤੇ ਬਹੁਤ ਵਧੀਆ ਰੇਹਾਂ ਸਪਰੇਹਾਂ ਨੇ ਠੀਕ ਹੈ ਸਰ ਅਤੇ ਸਾਨੂੰ ਮਤਲਬ ਵੀ ਅਸੀਂ ਜਦੋਂ ਵੀ ਮਤਲਬ ਤੁਹਾਡੀ ਸ਼ੋਪ ਦਾ ਸਾਨੂੰ ਟਾਈਮ ਵਗੈਰਾ ਵੀ ਦੱਸ ਦਿਉ ਅਤੇ ਵੀ ਕਿਉਂਕਿ ਅਸੀਂ ਸ਼ਹਿਰ ਦੇ ਵਿੱਚ ਨਵੇਂ ਨਵੇਂ ਸ਼ਿਫਟ ਹੋਏ ਹਾਂ ਤੇ ਅਸੀਂ ਉਸ ਟਾਈਮ ਵੀ ਮਤਲਬ ਜਿਸ ਕੁ ਟਾਈਮ ਅਸੀਂ ਫਰੀ ਹੋਏ ਤਾਂ ਅਸੀਂ ਆ ਕੇ ਲੈ ਜਾਂਗੇ ਠੀਕ ਹੈ ਸਰ ਅਤੇ ਅਸੀਂ ਜਦੋਂ ਮਰਜ਼ੀ ਆ ਸਕਦੇ ਹਾਂ ਅਤੇ ਸਰ ਸਾਨੂੰ ਵਧੀਆ ਕਿਸਮ ਦੀਆਂ ਰੇਹਾਂ ਸਪਰੇਹਾਂ ਮਿਲਣਗੀਆ ਠੀਕ ਹੈ ਸਰ ਅਤੇ ਸਬਜ਼ੀਆਂ 'ਚ ਪਾਉਣ ਲਈ ਵੀ ਅਤੇ ਸਬਜ਼ੀਆਂ ਕਿਹੜੀਆਂ ਕਿਹੜੀਆਂ ਦੇ ਬੀਜ਼ ਨੇ ਤੁਹਾਡੇ ਕੋਲ ਕਿਹੜੀਆਂ ਕਿਹੜੀਆਂ ਸਬਜ਼ੀਆਂ ਦੱਸ ਸਕਦੇ ਹੋ ਠੀਕ ਹੈ ਸਰ ਠੀਕ ਹੈ ਕੋਈ ਗੱਲ ਨਹੀਂ ਸਰ ਜਿੱਦੇ ਅਸੀਂ ਆਏ ਤਾਂ ਤੁਹਾਨੂੰ ਕਾਲ ਕਰਕੇ ਦੱਸ ਦਾਂਗੇ ਠੀਕ ਹੈ ਜੀ ਧੰਨਵਾਦ